ਜਿਵੇਂ ਕਿ ਅੱਜ ਕੱਲ੍ਹ ਦੇ ਟਾਈਮ ਵਿੱਚ ਸਿਹਤਮੰਦ ਰਹਿਣ ਲਈ ਸਾਨੂੰ ਸਫਾਈ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਉੱਦਾਂ ਹੀ ਅਸੀਂ ਆਪਣੇ ਘਰ ਦੇ ਬਾਹਰ ਚੰਗੀ ਤਰ੍ਹਾਂ ਸਫਾਈ ਦਾ ਧਿਆਨ ਰੱਖਦੇ ਹਨ ਜਿਵੇਂ ਕਿ ਸਾਡੇ ਪੋਲੀਟੀਸ਼ੀਅਨਜ਼ ਹਨ ਉਹਨਾਂ ਨੇ ਸਫਾਈ ਦਾ ਸਫਾਈ ਅਭਿਆਨ ਦੇ ਇੱਕ ਮੁਹਿੰਮ ਚਲਾਈ ਹੋਈ ਹੈ ਜਿਸ ਨੂੰ ਪਿੰਡਾਂ ਵਿੱਚ ਨਰੇਗਾ ਬੋਲਿਆ ਜਾਂਦਾ ਹੈ ਅਤੇ ਇੱਥੇ ਸਰਕਾਰ ਨੇ ਬਹੁਤ ਹੀ ਵਧੀਆ ਗੱਟ ਗੱਟਰ ਬਣਾਏ ਹਨ ਤਾਂ ਕਿ ਸਾਫ ਪਾਣੀ ਗੰਦੇ ਪਾਣੀ ਵਿੱਚ ਨਾ ਮਿਲ ਸਕੇ ਅਤੇ ਇਸੇ ਤਰ੍ਹਾਂ ਨਦੀਆਂ ਅਤੇ ਨਾਲਿਆਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਾਫ ਕੀਤਾ ਜਾਂਦਾ ਹੈ ਤਾਂ ਕਿ ਮੱਖੀ ਅਤੇ ਮੱਛਰ ਪੈਦਾ ਨਾ ਹੋ ਸਕਣ ਇਸ ਤਰ੍ਹਾਂ ਹੀ ਸਫਾਈ ਦਾ ਧਿਆਨ ਸਾਡੇ ਨਿਵਾਸੀਆਂ ਵੱਲੋਂ ਵੀ ਰੱਖਿਆ ਜਾਂਦਾ ਹੈ